ਟਕਨੋਲੋਜੀ ਵਿਦੇਸ਼ਾਂ ਦਾ ਕਾਰਜਾਂ ਲਈ ਵਿਗਿਆਨਿਕ ਗਿਆਨ ਦੀ ਵਰਤੋਂ ਹੈ ਟਕਨੋਲੋਜੀ ਵਿਗਿਆਨਿਕ ਸਿਧਾਂਤਾਂ ਦੀ ਵਰਤੋਂ ਕਰਦੀ ਹੈ ਅਤੇ ਉਹਨਾਂ ਨੂੰ ਵਾਧਾ ਨੂੰ ਵਾਤਾਵਰਨ ਨੂੰ ਬਦਲਣ ਲਈ ਲਾਗੂ ਕਰਦੀ ਜਿਸ ਦੇ ਵਿੱਚ ਮਨੁੱਖ ਰਹਿੰਦੇ ਨੇ ਟਕਨੋਲੋਜੀ ਉਦਯੋਗ ਜਾਂ ਹੋਰ ਮਨੁੱਖੀ ਨਿਰਮਾਣ ਨੂੰ ਅੱਗੇ ਵਧਾਉਣ ਲਈ ਵਿਗਿਆਨਿਕ ਸਿਧਾਂਤਾਂ ਦੀ ਵਰਤੋਂ ਕਰ ਸਕਦੀ ਹੈ ਟਕਨੋਲੋਜੀ ਨੇ ਆਵਾਜਾਈ ਉਦਯੋਗਾਂ ਦੀ ਇਸ ਤਰ੍ਹਾਂ ਮਦਦ ਕੀਤੀ ਹੈ ਜਿਵੇਂ ਕਿ ਕਿਤੇ ਵੀ ਜਾਣਾ ਹੋਵੇ ਤਾਂ ਫਿਰ ਉਹਨਾਂ ਨੂੰ ਅਸੀਂ ਬੱਸ ਟਰੇਨਾਂ ਫਲਾਈ ਉਹਨਾਂ ਨੂੰ ਬੁੱਕ ਕਰਵਾ ਸਕਦੇ ਹਾਂ ਆਵਾਜਾਈ ਦੇ ਸਾਧਨਾਂ ਨੂੰ ਜਾਂ ਜਿਹੜੀ ਟਿਕਟ ਆ ਉਹ ਵਾਪਸ ਵੀ ਲੈ ਸਕਦੇ ਹਾਂ ਕਿਤੇ ਇੱਕ ਇੱਕ ਕਿਤੇ ਵੀ ਦੂਰ ਜਾਣਾ ਹੋਵੇ ਤਾਂ ਰੇਲ ਗੱਡੀਆਂ ਸਥਿਤੀ ਦੀ ਜਾਂਚ ਕਰ ਸਕਦੇ ਹਾਂ ਫਾਸਟ ਟਰੈਕ ਕਰ ਸਕਦੇ ਆਨਲਾਈਨ ਲਾਈਸੈਂਸ ਵੀ ਪ੍ਰਾਪਤ ਕਰ ਸਕਦੇ ਹਾਂ ਤਾਂ ਇਸ ਤਰ੍ਹਾਂ ਟਕਨੋਲੋਜੀ ਨੇ ਆਵਾਜਾਈ ਉਦਯੋਗ ਦੀ ਮਦਦ ਕੀਤੀ ਹੈਗੀ